ਪਾਣੀ ਦੀ ਲੋੜ ਸਾਨੂੰ ਦਿਨ 'ਚ ਹੀ ਸ਼ੁਰੂਆਤ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਪਾਣੀ ਪਹਿਲੀ ਲੋੜ ਹੈ ਕਿ ਅਸੀਂ ਨਹਾਉਣਾ ਨਹਾਉਣ ਤੋਂ ਬਾਅਦ ਘਰ ਦੇ ਕੰਮਾਂ ਦੇ ਲਈ ਜਿਵੇਂ ਕਿ ਬਰਤਨ ਧੋਣੇ ਅ ਪੀਣ ਵਾਲਾ ਪਾਣੀ ਘਰ ਦੀ ਸਾਫ਼ ਸਫ਼ਾਈ ਦੇ ਵਿੱਚ ਵੀ ਪਾਣੀ ਦੀ ਵਰਤੋਂ ਹੁੰਦੀ ਹੈ ਪੌਦਿਆਂ ਨੂੰ ਪਾਣੀ ਦੇਣ ਦੇ ਲਈ ਵੀ ਪਾਣੀ ਦੀ ਵਰਤੋਂ ਹੁੰਦੀ ਹੈ ਸਬਜ਼ੀ ਵਗੈਰਾ ਧੋਣ ਅਤੇ ਬਣਾਉਣ 'ਚ ਵੀ ਪਾਣੀ ਦੀ ਲੋੜ ਹੁੰਦੀ ਹੈ ਤਾਂ ਪਾਣੀ ਮਨੁੱਖ ਦੇ ਜੀਵਨ ਵਿੱਚ ਕਾਫ਼ੀ ਮਾਇਨੇ ਰੱਖਦਾ ਪਾਣੀ ਬਿਨਾਂ ਜ਼ਿੰਦਗੀ ਨਹੀਂ ਹੈ ਤਾਂ ਪਾਣੀ ਨੂੰ ਜਿੰਨਾ ਹੋ ਸਕੇ ਉਨਾ ਘੱਟ ਦੁਰਵਰਤੋਂ ਕਰੋ ਤਾਂ ਕਿ ਅਗਲੀਆਂ ਪੀੜ੍ਹੀਆਂ ਨੂੰ ਪਾਣੀ ਜਿਹੜਾ ਹੈਗਾ ਹੈ ਬਚ ਸਕੇ ਅਤੇ ਜੀਵਨ ਬਚ ਸਕੇ